ਫ਼ੀਸ ਦੇ ਢਾਂਚੇ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਬਾਏ ਹੱਥ ਹੱਥੀਂ ਆਪਣੇ ਪੈਸੇ ਦਿੱਤੇ ਜਾਂਦੇ ਨੇ ਜਾਂ ਫਿਰ ਔਨਲਾਇਨ ਟਰਾਂਸਫਰ ਕੀਤੀ ਜਾਂਦੀ ਆ ਔਨਲਾਈਨ ਟਰਾਂਸਫਰ ਵਿੱਚ ਜਿਵੇਂ ਕਿ ਗੂਗਲ ਪੇ ਪੇਟੀਐੱਮ ਫ਼ੋਨਪੇ ਆਦਿ ਇੱਦਾਂ ਦੀਆਂ ਐੱਪਸ ਵਰਤੀਆਂ ਜਾਂਦੀਆਂ ਨੇ ਹੱਥੀਂ ਗੱਲ ਕੀਤੀ ਜਾਵੇ ਤਾਂ ਹੱਥੀਂ ਇੱਕ ਆਪਾਂ ਸਿੱਧਾ ਪੈਸੇ ਦੇ ਦਿੰਦੇ ਨੇ ਮਤਲਬ ਕਿ ਸਿੱਧਾ ਪੈਸੇ ਦੇ ਦਿੰਦੇ ਨੇ ਸਕੂਲ ਨੂੰ ਜਾਂ ਹੁੰਦਾ ਹੈ ਆਪਣਾ ਡਰਾਫਟ ਦੇ ਥਰੂ ਜਾਂ ਚੈੱਕ ਦੇ ਥਰੂ ਉਨ੍ਹਾਂ ਨੂੰ ਪੈਸੇ ਦਿੰਦੇ ਨੇ ਮੈਂ ਵ ਗੱਲ ਕਰਾਂ ਤਾਂ ਮੈਂ ਆਪਣੇ ਬੱਚਿਆਂ ਦੀ ਫ਼ੀਸ ਔਨਲਾਈਨ ਹੀ ਪੇਅ ਕਰਦਾਂ ਕਿਉਂਕਿ ਇਸ ਵਿੱਚ ਸਮੇਂ ਦੀ ਬੱਚਤ ਹੈ ਅਤੇ ਟਾਇਮ ਦੀ ਬੱਚਤ ਹੈ ਅਤੇ ਮੈਨੂੰ ਉੱਥੇ ਸਕੂਲ ਵਿੱਚ ਜਾਣ ਦੀ ਜ਼ਰੂਰਤ ਨਹੀਂ ਪੈਂਦੀ